ਸਤਿ ਸ਼੍ਰੀ ਅਕਾਲ ਫਿਲਹਾਲ ਤਾਂ ਭਾਰਤ ਦੀ ਕੋਈ ਸਰਕਾਰੀ ਭਾਸ਼ਾ ਨਹੀਂ ਹੈ ਬਟ ਸਿਰਫ ਹਿੰਦੀ ਅਤੇ ਅੰਗਰੇਜ਼ੀ ਨੂੰ ਹੀ ਸਰਕਾਰੀ ਭਾਸ਼ਾ ਮੰਨਿਆ ਗਿਆ ਹੈ ਹਿੰਦੀ ਬਹੁਤ ਘੱਟ ਜਗ੍ਹਾ ਯੂਜ ਹੁੰਦੀ ਹੈ ਅਤੇ ਫੋਰਟੀ ਥ੍ਰੀ ਪਰਸੈਂਟ ਲੋਕ ਹਿੰਦੀ ਵਰਤਦੇ ਹਨ ਇੰਗਲਿਸ਼ ਸਿਰਫ ਓਫੀਸ਼ਅਲ ਪਰਪਸ ਵਾਸਤੇ ਹੀ ਯੂਜ ਕੀਤੀ ਜਾਂਦੀ ਹੈ ਫਿਲਹਾਲ ਭਾਰਤ ਵਿੱਚ ਹੋਰ ਵੀ ਕਈ ਬੋਲੀਆਂ ਹਨ ਜਿੱਦਾਂ ਗੁਜਰਾਤੀ ਮਰਾਠੀ ਤੇਲਗੂ ਇਹ ਵੱਖਰੇ ਵੱਖਰੇ ਸਟੇਟਾਂ ਅਤੇ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਵਰਤੀ ਜਾਂਦੀ ਹੈ ਇਹ ਸਭ ਵਿਭਿੰਨਤਾ ਦਾ ਮੈਂ ਇਹੀ ਸੋਚਦਾ ਹਾਂ ਕਿ ਇਸ ਵਿਭਿੰਨਤਾ ਨਾਲ ਅਸੀਂ ਲੋਕਾਂ ਨਾਲ ਚੰਗੀ ਤਰ੍ਹਾਂ ਗੱਲ ਕਰ ਸਕਦੇ ਹਾਂ ਅਤੇ ਸਾਨੂੰ ਵੱਖਰੀ ਵੱਖਰੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾ ਅਤੇ ਹੋਰ ਵੀ ਵੱਖਰੇ ਵੱਖਰੇ ਰੀਤੀ ਰਿਵਾਜਾਂ ਅਤੇ ਕਲਚਰ ਬਾਰੇ ਪਤਾ ਲੱਗੂਗਾ ਵੱਖਰੀਆਂ ਵੱਖਰੀਆਂ ਭਾਸ਼ਾ ਹੋਣ ਦਾ ਇੱਕ ਸਾਨੂੰ ਫਾਇਦਾ ਹੈ ਕਿ ਸਾਨੂੰ ਪਤਾ ਲੱਗੇਗਾ ਕਿ ਹੋਰ ਭਾਸ਼ਾ ਵਿੱਚ ਕਿਸ ਚੀਜ਼ ਨੂੰ ਕਿੱਦਾਂ ਕਿਹਾ ਜਾ ਸਕਦਾ ਅਤੇ ਇੱਕ ਸ਼ਬਦ ਦੇ ਕਿੰਨੇ ਮਤਲਬ ਨਿਕਲ ਸਕਦੇ ਨੇ ਅਲੱਗ ਅਲੱਗ ਭਾਸ਼ਾ ਵਿੱਚ ਅਲੱਗ ਅਲੱਗ ਭਾਸ਼ਾਵਾਂ ਹੋਣ ਦਾ ਹੋਣ ਨਾਲ ਹੀ ਸਾਡਾ ਭਾਰਤ ਇੱਕ ਵੱਧ ਭਾਸ਼ਾ ਤੋਂ ਬੋਲਣ ਵੱਧ ਤੋਂ ਵੱਧ ਭਾਸ਼ਾ ਬੋਲਣ ਵਾਲਾ ਦੇਸ਼ ਕਿਹਾ ਜਾਂਦਾ ਹੈ